ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਪਿੰਕੀ ਹੈ ਮੈਂ ਇਸਲਾਮਾਬਾਦ ਮੁਹੱਲੇ ਦੀ ਰਹਿਣ ਵਾਲੀ ਹਾਂ ਗੁਰਦਾਸਪੁਰ ਵਿੱਚ ਅਤੇ ਮੈਨੂੰ ਸਿਲਾਈ ਕਢਾਈ ਦਾ ਬਹੁਤ ਸ਼ੌਂਕ ਹੈ ਮੈਨੂੰ ਬਚਪਨ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਸੀ ਸਿਲਾਈ ਕਢਾਈ ਦਾ ਅਤੇ ਮੇਰੀ ਮਮਾ ਪਾਪਾ ਨੇ ਮੈਨੂੰ ਸਿਲਾਈ ਕਢਾਈ ਤੇ ਕਿਸੇ ਦੀ ਦੁਕਾਨ 'ਤੇ ਲਗਾ ਦਿੱਤਾ ਅਤੇ ਮੈਂ ਉੱਥੇ ਜਾ ਕੇ ਮੈਂ ਸੋਹਣੇ ਸੋਹਣੇ ਕਢਾਈ ਸਿਲਾਈ ਕਰਨ ਲੱਗ ਪਈ ਅਤੇ ਮੇਰਾ ਕੰਮ ਮਤਲਬ ਕਿ ਕੰਮ ਮੇਰਾ ਖੁੱਲ੍ਹ ਗਿਆ ਲੋਕਾਂ ਨੇ ਬਹੁਤ ਪਸੰਦ ਕੀਤਾ ਮੇਰਾ ਸਿਲਾਈ ਕਢਾਈ ਅਤੇ ਬੁਣਾਈ ਵੀ ਬਹੁਤ ਪਸੰਦ ਕੀਤਾ ਅਤੇ ਮੇਰੇ ਨਾਲ ਵੱਧ ਤੋਂ ਵੱਧ ਮੇਰੇ ਜ਼ਿਆਦਾ ਕਸਟਮਰ ਬਣ ਗਏ ਅਤੇ ਮੈਂ ਫਿਰ ਆਪਣੀ ਦੁਕਾਨ ਖੋਲਣ ਦੀ ਮਤਲਬ ਕਿ ਕੋਸ਼ਿਸ਼ ਕੀਤੀ ਅਤੇ ਮੇਰੇ ਮੰਮਾ ਪਾਪਾ ਨੇ ਮੈਂ ਆਪਣੇ ਮਤਲਬ ਕਿ ਮਮਾ ਪਾਪਾ ਨੂੰ ਬੋਲਿਆ ਕਿ ਮੈਨੂੰ ਸ਼ੌਂਕ ਹੈ ਸਿਲਾਈ ਕਢਾਈ ਦਾ ਅਤੇ ਮੇਰੇ ਮਮਾ ਪਾਪਾ ਨੇ ਮੈਨੂੰ ਦੁਕਾਨ ਖੋਲ੍ਹ ਦਿੱਤੀ ਅਤੇ ਮੇਰਾ ਕੰਮ ਚੱਲ ਪਿਆ ਸਿਲਾਈ ਕਢਾਈ ਵਿੱਚ ਅਤੇ ਮੈਂ ਬਹੁਤ ਵਧੀਆ ਤਰੀਕੇ ਨਾਲ ਸਿਲਾਈ ਕਢਾਈ ਕੀਤੀ ਲੋਕਾਂ ਨੂੰ ਬਹੁਤ ਪਸੰਦ ਆਇਆ ਮੇਰਾ ਕੰਮ ਸਿਲਾਈ ਕਢਾਈ ਦਾ ਅਤੇ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਜੀ ਅਤੇ ਸਲਾਈ ਕਢਾਈ ਕਰ ਕਰ ਕੇ ਮੇਰੇ ਪੇਨ ਬੈਕ ਸਾਈਡ ਪੇਨ ਹੋਣ ਲੱਗ ਗਈ ਮੈਂ ਫਿਰ ਵੀ ਤਾਂ ਵੀ ਨਹੀਂ ਆਪਣਾ ਕੰਮ ਛੱਡਿਆ ਫਿਰ ਵੀ ਮੈਂ ਬਹਿ ਕੇ ਆਪਣਾ ਸਿਲਾਈ ਕਢਾਈ ਕੰਮ ਕੀਤਾ ਅਤੇ ਲੋਕਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਮੇਰਾ ਸਿਲਾਈ ਕਢਾਈ ਦਾ ਸ ਕੰਮ ਅਤੇ ਇਸ ਕਰਕੇ ਮੈਨੂੰ ਮੇਰਾ ਕੰਮ ਵੱਧ ਤੋਂ ਵੱਧ ਚੱਲਣ ਲੱਗ ਪਿਆ ਸਿਲਾਈ ਕਢਾਈ ਦਾ ਹੁਣ ਮੈਂ ਮੇਰੇ ਪੇਨ ਦਰਦ ਹੁੰਦੀ ਹੈ ਤਾਂ ਵੀ ਬੈਠ ਕੇ ਕੰਮ ਕਰਨਾ ਪੇਨ ਦਰਦ ਹੋਣ ਲੱਗ ਗਈ ਮੇਰੇ ਲੱਕ ਵਗੈਰਾ ਪਿੱਛੇ ਬੈਕ ਸਾਈਡ ਦਰਦ ਹੋਣ ਲੱਗ ਗਈ ਮੈਂ ਤਾਂ ਵੀ ਕੰਮ ਨਹੀਂ ਛੱਡਿਆ ਆਪਣਾ ਕਰਨ ਤੋਂ ਤਾਂ ਵੀ ਮੈਂ ਆਪਣਾ ਹੌਲੀ ਹੌਲੀ ਕੰਮ ਕੀਤਾ ਅਤੇ ਲੋਕਾਂ ਨੇ ਬਹੁਤ ਮੇਰਾ ਕੰਮ ਪਸੰਦ ਕੀਤਾ ਸਿਲਾਈ ਕਢਾਈ ਦਾ ਫਿਰ ਬੁਣਾਈ ਦਾ ਵੀ ਬਹੁਤ ਜ਼ਿਆਦਾ ਮਤਲਬ ਕਿ ਪਸੰਦ ਕੀਤਾ ਇਸ ਕਰਕੇ ਮੈਂ ਵਧੀਆ ਤੋਂ ਵਧੀਆ ਤਰੀਕੇ ਨਾਲ ਆਪਣਾ ਸਿਲਾਈ ਕਢਾਈ ਦਾ ਬਹੁਤ ਵਧੀਆ ਤਰੀਕੇ ਨਾਲ ਮੈਂ ਆਪਣਾ ਕੰਮ ਕੀਤਾ ਹੋ ਸਕੇ ਮੇਰੇ ਹੋਰ ਜ਼ਿਆਦਾ ਕਸਟਮਰ ਵੱਧ ਗਏ ਆ ਸਿਲਾਈ ਕਢਾਈ ਅਤੇ ਉਹਨਾਂ ਨੇ ਮੇਰਾ ਕੰਮ ਪਸੰਦ ਕੀਤਾ ਲੋਕਾਂ ਨੇ ਹੋਰ ਜ਼ਿਆਦਾ ਕਸਟਮਰ ਮੇਰੇ ਵੱਧ ਗਏ ਹੈ ਮੈਂ ਹੋਰ ਵਧੀਆ ਤਰੀਕੇ ਨਾਲ ਵਧੀਆ ਸੂਟਾਂ 'ਤੇ ਡਿਜ਼ਾਇਨ ਪਾ ਪਾ ਕੇ ਲੋਕਾਂ ਨੂੰ ਸੂਟ ਸੀ ਕੇ ਦਿੱਤੇ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਮੇਰਾ ਕੰਮ ਪਸੰਦ ਕੀਤਾ ਸਿਲਾਈ ਕਢਾਈ ਦਾ ਅਤੇ ਬਾ ਮੈਨੂੰ ਬਹੁਤ ਜ਼ਿਆਦਾ ਆਮਦਨ ਹੋਣ ਲੱਗ ਪਈ ਇਸ ਕਰਕੇ ਮੇਰੀ ਥੋੜ੍ਹੀ ਬਹੁਤ ਮੇਰੇ ਦਰਦ ਬੈਠ ਬੈਠ ਕੇ ਸਰੀਰ ਆ ਸਰੀਰ ਵੀ ਦਰਦ ਹੋਣ ਲੱਗ ਪਏ ਮੇਰੇ ਕੰਮ ਕਰ ਕਰ ਕੇ ਤਾਂ ਵੀ ਮੈਂ ਆਪਣਾ ਸਿਲਾਈ ਕਢਾਈ ਦਾ ਕੰਮ ਨਾ ਨਹੀਂ ਛੱਡਿਆ ਕਰਨ ਤੋਂ ਤਾਂ ਵੀ ਮੈਂ ਵੱਧ ਤੋਂ ਵੱਧ ਕੰਮ ਕੀਤਾ ਸਿਲਾਈ ਕਢਾਈ ਬੁਣਾਈ ਦਾ